ਚਾਰ ਜਨਵਰੀ ਉੱਨੀ ਸੌ ਛਿਆਨਵੇਂ ਬਾਰ੍ਹਾਂ ਮਾਰਚ ਦੋ ਹਜ਼ਾਰ ਚਾਰ ਚੌਵੀ ਜੁਲਾਈ ਪੰਦਰਾਂ ਸੌ ਸੱਠ ਅਠਾਰਾਂ ਅਪ੍ਰੈਲ ਅਠਾਰਾਂ ਸੌ ਚੁਰਾਸੀ ਇੱਕੀ ਜੂਨ ਉੱਨੀ ਸੌ ਪੰਜਾਹ